ਮੈਨੂੰ ਤਕਨੀਕੀ ਅਤੇ ਟਾਂਕਿਆਂ ਨਾਲ ਕੰਮ ਕਰਨਾ ਸਭ ਤੋਂ ਚੰਗਾ ਅਤੇ ਫਾਇਦੇਮੰਦ ਲੱਗਦਾ ਹੈ ਅੱਜ ਦੇ ਸਮੇਂ ਵਿੱਚ ਕੁਝ ਲੋਕ ਇਸ ਨੂੰ ਅਣਦੇਖਾ ਕਰਕੇ ਰੈਡੀਮੇਡ ਕੱਪੜੇ ਅਤੇ ਰੈਡੀਮੇਡ ਚੀਜ਼ਾਂ ਵਿੱਚ ਜਿਆਦਾ ਵਿਸ਼ਵਾਸ ਰੱਖਣ ਲੱਗ ਗਏ ਨੇ ਪਰੰਤੂ ਮੈਨੂੰ ਅੱਜ ਵੀ ਪੁਰਾਣੇ ਟਾਈਮ ਦੇ ਹਿਸਾਬ ਨਾਲ ਟਾਂਕੇ ਅਤੇ ਕਢਾਈ ਬੁਨਾਈ ਸਲਾਈ ਕਰਨਾ ਬਹੁਤ ਚੰਗਾ ਲੱਗਦਾ ਹੈ ਮੈਨੂੰ ਇਨਾ ਵਿੱਚੋਂ ਸਭ ਤੋਂ ਚੰਗਾ ਲੱਗਦਾ ਹੈ ਟਾਂਕੇ ਲਾਣਾ ਅਤੇ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਬਣਾਉਣੀਆਂ ਜਿਵੇਂ ਕੀ ਸਿੰਧੀ ਟਾਂਕਾ ਲਾਣਾ ਭਰਮਾਂ ਤੋਪਾ ਗੰਢ ਤੋਪਾ ਸਿੱਪੀ ਟੋ ਤੋਪਾ ਨਲਕੀ ਧੁੱਪ ਆ ਗੋਟਾ ਪੱਟੀ ਜਾਂ ਮੁਕੈਸ਼ ਅਤੇ ਆਰੀ ਦੀ ਕੜਾਈ ਕਰਨੀ ਬਹੁਤ ਚੰਗੀ ਲੱਗਦੀ ਹੈ ਇਹਨਾਂ ਵਿੱਚੋਂ ਇੱਕ ਹੋਰ ਸਭ ਤੋਂ ਮਹੱਤਵਪੂਰਨ ਕਢਾਈ ਆਂਦੀ ਹੈ ਕਸ਼ਮੀਰੀ ਕਢਾਈ ਜਿਹੜੀ ਕੀ ਲੋਕ ਬਹੁਤ ਪਸੰਦ ਕਰਿਆ ਕਰਦੇ ਸੀ ਸਭ ਤੋਂ ਔਖੀ ਇਹਨਾਂ ਵਿੱਚੋਂ ਸਿੰਧੀ ਟਾਕਾਂ ਲਗਾ ਲਗਾਉਣ ਨਾ ਔਖਾ ਲੱਗਦਾ ਹੈ ਸਿੰ ਸਿੰਧੀ ਟਾਂਕਾ ਲਗਾਉਣ ਵਾਸਤੇ ਬਹੁਤ ਜਿਆਦਾ ਖੁੱਲਾ ਟਾਈਮ ਅਤੇ ਬਹੁਤ ਸਮਾਨ ਦੀ ਲੋੜ ਪੈਂਦੀ ਹੈ ਇਸ ਵਿੱਚ ਭਰਮਾਂ ਤੋਪਾ ਮੈਨੂੰ ਲਾਣਾ ਸਭ ਤੋਂ ਚੰਗਾ ਲੱਗਦਾ ਹੈ ਇਹ ਜਿਹੜੇ ਤੋਪੇ ਜਾਂ ਗੰਢ ਪੱਟੀ ਜਾਂ ਗੋਟਾ ਪੱਟੀ ਜਾਂ ਮੁਕੈਸ਼ ਜਾਂ ਆਰੇ ਦੀ ਕਢਾਈ ਕਰਨੀ ਬਹੁਤ ਵਧੀਆ ਲੱਗਦੀ ਹੈ ਇਹ ਕਢਾਈਆਂ ਕਰਨੀਆ ਤਾਂ ਬਹੁਤ ਵਧੀਆ ਲੱਗਦੀਆਂ ਹਨ ਪਰ ਇਹਨਾਂ ਨੂੰ ਟਾਈਮ ਵੀ ਬਹੁਤ ਲੱਗਦਾ ਹੈ